ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਮਨੋਰੰਜਨ ਬਦਲਿਆ ਹੈ ਜਿਵੇਂ ਕਿ ਪਹਿਲਾਂ ਲੋਕ ਸ਼ਾਮ ਨੂੰ ਗਲੀ ਮੁਹੱਲੇ ਵਿੱਚ ਇਕੱਠੇ ਹੋ ਕੇ ਗਾਉਂਦੇ ਅਤੇ ਨੱਚਦੇ ਸਨ ਪਰ ਹੁਣ ਅੱਜ ਦੇ ਸਮੇਂ ਵਿੱਚ ਲੋਕ ਘਰੋਂ ਬਾਹਰ ਆਉਣਾ ਬੰਦ ਕਰ ਦਿੱਤਾ ਹੈ ਘਰੋਂ ਬਾਹਰ ਹੀ ਨਹੀਂ ਆਉਂਦੇ ਜਿਸ ਕਰਕੇ ਉਹ ਘਰ ਬੈਠੇ ਫੋਨਾਂ ਵਿੱਚ ਗੇਮਾਂ ਖੇਡਦੇ ਰਹਿੰਦੇ ਹਨ ਅਤੇ ਕੰਪਿਊਟਰ ਜਾਂ ਟੀ ਵੀ ਵਿੱਚ ਫਿਲਮਾਂ ਵੇਖਦੇ ਰਹਿੰਦੇ ਹਨ ਜਿਸ ਦਾ ਕਿ ਬਹੁਤ ਹੀ ਸੱਭਿਆਚਾਰ ਉੱਤੇ ਪ੍ਰਭਾਵ ਪੈ ਰਿਹਾ ਹੈ ਜਿਸ ਨਾਲ ਲੋਕ ਘਰ ਰਹਿ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਐਕਸਰਸਾਈਜ਼ ਨਹੀਂ ਕਰਦੇ ਲੋਕ ਬਾਹਰ ਨਹੀਂ ਜਾਂਦੇ ਜਿਸ ਨਾਲ ਉਹਨਾਂ ਨੂੰ ਬਹੁਤ ਹੀ ਗੰਭੀਰ ਬਿਮਾਰੀਆਂ ਨਾਲ ਉਲਝਣਾ ਪੈਂਦਾ ਹੈ ਜਿਵੇਂ ਕਿ ਦਿਲ ਦਾ ਮਰੀਜ਼ ਦਰਦ ਦੇ ਮਰੀਜ਼ ਸੋ ਇਸ ਕਰਕੇ ਸਾਨੂੰ ਬਾਹਰ ਘੁੰਮਣਾ ਫਿਰਨਾ ਚਾਹੀਦਾ ਹੈ ਅਤੇ ਆਪਣੇ ਸਾਰੇ ਗਲੀ ਗੁਆਂਢ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਗੁਆਂਢੀ ਰੱਬ ਦਾ ਰੂਪ ਹੁੰਦੇ ਹਨ ਉਹਨਾਂ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਰਹਿਣਾ ਚਾਹੀਦਾ ਹੈ